ਦੂਜੇ ਸ਼ਹਿਰ ਦੇ ਸਕੂਲਾਂ ਦੇ ਮੁਕਾਬਲੇ ਸਾਡੇ ਪਿੰਡ ਕਸਬੇ ਦੇ ਸਕੂਲਾਂ ਵਿੱਚ ਅਲੱਗ ਅਲੱਗ ਸੋਚ ਬਣੀ ਹੋਈ ਹੈ ਕੁਝ ਲੋਕਾਂ ਦੀ ਸੋਚ ਇਹ ਹੈ ਕਿ ਜੇ ਸ਼ਹਿਰਾਂ ਦੇ ਸਕੂਲ ਹਨ ਉਹਨਾਂ ਦੇ ਵਿੱਚ ਵਧੀਆ ਪੜ੍ਹਾਈ ਵਧੀਆ ਬੈਠਣ ਲਈ ਸਥਾਨ ਵਧੀਆ ਪੱਖੇ ਅਤੇ ਹੋਰ ਕਾਫ਼ੀ ਸਹੂਲਤਾਂ ਹਨ ਜੋ ਕਿ ਪਿੰਡਾਂ ਦੇ ਸਕੂਲਾਂ ਵਿੱਚ ਨਹੀਂ ਹਨ ਇੱਥੋਂ ਤੱਕ ਵੀ ਕਿ ਸਕੂਲਾਂ ਦੇ ਵਿੱਚ ਸ਼ਹਿਰੀ ਸਕੂਲਾਂ ਦੇ ਸਕੂਲ ਹੈ ਉਨ੍ਹਾਂ ਦੇ ਵਿੱਚ ਸਟਾਫ਼ ਪੂਰਾ ਹੈ ਅਤੇ ਸਟਾਫ਼ ਪੂਰਾ ਹੋਣ ਦੇ ਨਾਲ ਨਾਲ ਅਨੁਸ਼ਾਸਨ ਦੇ ਵੀ ਬਹੁਤ ਵਧੀਆ ਗੱਲ ਹੈ ਪਿੰਡਾਂ ਦੇ ਵਿੱਚ ਗਰੀਬੀ ਹੋਣ ਦੇ ਕਾਰਨ ਲੋਕਾਂ ਦੇ ਕੋਲ ਪੜ੍ਹਾਈ ਦੀ ਇੰਨੀ ਸਹੂਲਤ ਨਹੀਂ ਹੈ ਨਾ ਹੀ ਅਨਪੜ੍ਹ ਹੋਣ ਦੇ ਨਾਤੇ ਮਾਂ ਬਾਪ ਉਹਨਾਂ ਚੰਗੀ ਸਿੱਖਿਆ ਦਿੰਦੇ ਹਨ ਪਰ ਫਿਰ ਵੀ ਪਿੰਡ ਦੇ ਸਕੂਲਾਂ ਦੇ ਵਿੱਚ ਜਿਹੜਾ ਸਟਾਫ ਹੈ ਆਪਣੀ ਮਿਹਨਤ ਦੇ ਨਾਲ ਸ਼ਹਿਰੀ ਸਕੂਲਾਂ ਦੇ ਬਰਾਬਰ ਬੱਚਿਆਂ ਨੂੰ ਲਿਜਾ ਰਿਹਾ ਹੈ ਇਹ 'ਚ ਕੋਈ ਅਥਕਥਨੀ ਨਹੀਂ ਹੈ ਚੰਗਾ ਹੋਵੇ ਕਿ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਪਿੰਡਾਂ ਦੇ ਬੱਚੇ ਸ਼ਹਿਰੀ ਸਕੂਲਾਂ ਮਾਣਦੇ ਹੋਏ ਆਪਣਾ ਪੱਧਰ ਉੱਚਾ ਕਰ ਸਕਣ